ਹਾਂਜੀ ਕਿੱਦਾਂ ਆਪਾਂ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਬਹੁਤ ਸਾਰੇ ਬਦਲਾਅ ਹੁਣ ਲਿਆਉਣੇ ਚਾਹੀਦੇ ਹੈ ਆਪਾਂ ਨੂੰ ਵੱਧ ਤੋਂ ਵੱਧ ਤਰਨਤਾਰਨ ਜ਼ਿਲ੍ਹੇ ਵਿੱਚ ਰੁੱਖ ਲਗਾਉਣੇ ਚਾਹੀਦੇ ਹੈ ਆਪਾਂ ਨੂੰ ਕਿਹੜਾ ਪੈਟਰੋਲ ਅਤੇ ਡੀਜ਼ਲ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਕਿਹੜੇ ਮਤਲਬ ਆਪਣੇ ਕਿਹੜੇ ਆ ਪ੍ਰਦੂਸ਼ਣ ਵਾਲੇ ਵਾਹੀਕਲ ਉਹਨਾਂ ਨੂੰ ਘੱਟ ਵਰਤਣਾ ਚਾਹੀਦਾ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੈਟਰੀਜੇਸ਼ਨ ਵਾਹੀਕਲ ਵਰਤਣੇ ਚਾਹੀਦੇ ਅੱਜ ਕੱਲ੍ਹ ਤਾਂ ਬਿਜਲੀ ਵਾਲੀਆਂ ਸਕੂਟਰੀਆਂ ਵੀ ਆ ਗਈਆਂ ਅਤੇ ਬਿਜਲੀ ਵਾਲੀਆਂ ਗੱਡੀਆਂ ਵੀ ਆ ਗਈਆਂ ਆਪਾਂ ਨੂੰ ਵੱਧ ਤੋਂ ਵੱਧ ਸਾਈਕਲ ਵੀ ਵਰਤਣੇ ਚਾਹੀਦੇ ਆ ਕਿਹਦੇ ਨਾਲ ਆਪਣੀ ਸਿਹਤ ਵੀ ਠੀਕ ਰਹੂ ਅਤੇ ਆਪਣੇ ਤਰਨਤਾਰਨ ਦਾ ਮਹੌਲ ਵੀ ਠੀਕ ਰਹੂਗਾ ਜਿੱਦਾਂ ਹੁਣ ਆਪਾਂ ਨੂੰ ਤਰਨਤਾਰਨ ਵਿੱਚ ਸਾਫ਼ ਸਫ਼ਾਈ ਰੱਖਣੀ ਚਾਹੀਦੀ ਹੈ ਨਗਰ ਨਿਗਮ ਵਾਲੇ ਵੀ ਬਹੁਤ ਉਹ ਕਰ ਰਹੇ ਆ ਆਪਣਾ ਕਿੱਦਾਂ ਤਰਨਤਾਰਨ ਵਿੱਚ ਮੇਨ ਸ਼ ਅੱਡਾ ਨੂਰ ਆਪਣਾ ਕਹੀਏ ਤਾਂ ਬੋਹੜੀ ਚੌਂਕ ਆ ਬੋਹੜੀ ਚੌਂਕ ਵਿੱਚ ਆਪਣੇ ਨਾਕਾ ਵੀ ਲੱਗਾ ਆਪਾਂ ਨੂੰ ਟ੍ਰਿਪਲਿੰਗ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਮਤਲਬ ਵੱਖ ਵੱਖ ਤਰੀਕਿਆਂ ਨਾਲ ਤਰਨਤਾਰਨ ਸ਼ਹਿਰ ਦੀ ਕਿਹੜੇ ਵੀ ਤਰੀਕੇ ਨਾਲ ਆਪਣੀ ਤਰਨਤਾਰਨ ਸ਼ਹਿਰ ਉਹਨੂੰ ਆਪਾਂ ਨੂੰ ਵੱਧ ਤੋਂ ਵੱਧ ਰੱਖਣਾ ਚਾਹੀਦਾ ਵਾ ਤਰਨਤਾਰਨ ਸ਼ਹਿਰ ਵਿੱਚ ਆਪਣੇ ਜਿਹੜੇ ਲੋਕ ਆ ਉਹਨਾਂ ਨੂੰ ਆਮ ਤੌਰ ਕੇ ਰੱਖਣੇ ਚਾਹੀਦੇ ਆ